ਜਿਵੇਂ ਕਈ ਫੁੱਲ ਵੀ ਜਿਵੇਂ ਅਸੀਂ ਸਬਜ਼ੀਆਂ ਲਾਉਂਦੇ ਹਾਂ ਅਤੇ ਤਾਂ ਸਾਰੇ ਹੀ ਪੌਦੇ ਵਧੀਆ ਹੁੰਦੇ ਨੇ ਜਿਵੇਂ ਫੁੱਲਾਂ ਵਾਲੇ ਪੌਦੇ ਨੇ ਉਹ ਵੀ ਵਧੀਆ ਹੁੰਦੇ ਨੇ ਜਿਵੇਂ ਗੇਂਦਾ ਹੋ ਗਿਆ ਗਲੌਦੀ ਹੋ ਗਈ ਅਤੇ ਕੁੱਤਾ ਫੁੱਲ ਹੋ ਗਿਆ ਅਤੇ ਹੋਰ ਬ ਇੱਕ ਅ ਬਰਫ ਵਾਲਾ ਬੂਟਾ ਹੁੰਦਾ ਜਿਹਨੂੰ ਬਰਫ ਕਹਿੰਦੇ ਨੇ ਅਤੇ ਹੋਰ ਵੀ ਜਿਵੇਂ ਫਲਾਂ ਵਾਲੇ ਬੂਟੇ ਅਮਰੂਦ ਹੋ ਗਿਆ ਅਤੇ ਅੰਬ ਹੋ ਗਿਆ ਚੀਕੂ ਅਤੇ ਮਸੰਮੀ ਅਤੇ ਹੋਰ ਬਹੁਤ ਬੂਟੇ ਨੇ ਜਿਹੜੇ ਸਾਨੂੰ ਬਹੁਤ ਵਧੀਆ ਲੱਗਦੇ ਨੇ ਪਰ ਮੈਨੂੰ ਜ਼ਿਆਦਾ ਪਸੰਦ ਜਿਹੜੇ ਹੈਗੇ ਨੇ ਉਹ ਅਤੇ ਸਬਜ਼ੀ ਵਾਲੇ ਬੂਟਿਆਂ ਅਤੇ ਜ਼ਿਆਦਾ ਮੈਨੂੰ ਪਸੰਦ ਆ ਜਿਵੇਂ ਕਿ ਜਿਵੇਂ ਕਿ ਆਪਾਂ ਹੁਣ ਸਰਦੀ ਦੇ ਮੌਸਮ ਦੇ ਵਿੱਚ ਲਾਉਂਦੇ ਹਾਂ ਗਾਜਰ ਹੋ ਗਈ ਸਗ ਸ਼ਗਮਲ ਹੋ ਗਿਆ ਅਤੇ ਮੂਲੀ ਅਤੇ ਸਾਗ ਅਤੇ ਹੋਰ ਜਿਵੇਂ ਸਰਦੀ ਦੀ ਮੌਸਮ ਦੇ ਵਿੱਚ ਘੀਏ ਦੀ ਵੇਲ ਵੀ ਹੁੰਦੀ ਹੈ ਅਤੇ ਗਰਮੀਆਂ ਦੇ ਵਿੱਚ ਬੂਟੇ ਜਿਹੜੇ ਹੁੰਦੇ ਨੇ ਸਬਜ਼ੀ ਵਾਲੇ ਉਹ ਜਿਵੇਂ ਹੁਣ ਬਤਾਊਂ ਹੋ ਗਏ ਹੋਰ ਇੱਕ ਬਹੁਤ ਭਰਿੰਡੀਆਂ ਹੋ ਗਈਆਂ ਅਤੇ ਹੋਰ ਘੀਏ ਘੀਏ ਜਿਹੜੀ ਤੋਰੀਆਂ ਦੀ ਵੇਲ ਹੁੰਦੀ ਇਹ ਗਰਮੀ 'ਚ ਲੱਗਦੀ ਹੈ ਅਤੇ ਕਰੇਲਿਆਂ ਦੀ ਵੇਲ ਵੀ ਗਰਮੀ ਦੇ ਵਿੱਚ ਲੱਗਦੀ ਹੈ ਜ਼ਿਆਦਾ ਤੋਂ ਜ਼ਿਆਦਾ ਇਹ ਸਬਜ਼ੀਆਂ ਜਿਵੇਂ ਕਿ ਅ ਸਿਆਲ ਦੇ ਵਿੱਚ ਤਾਂ ਜ਼ਿਆਦਾ ਤੋਂ ਜ਼ਿਆਦਾ ਸਾਗ ਹੀ ਚੱਲਦਾ ਹੈ ਇਸ ਕਰਕੇ ਜ਼ਿਆਦਾ ਤੋਂ ਜ਼ਿਆਦਾ ਸਾਨੂੰ ਸਬਜ਼ੀਆਂ ਹੀ ਵਧੀਆ ਲੱਗਦੀਆਂ ਨੇ